ਸਾਡੇ ਇਲਾਕੇ ਦਾ ਆਮਦਨ ਦਾ ਮੇਨ ਸੋਰਸ ਖੇਤੀਬਾੜੀ ਹੈ ਖੇਤੀਬਾੜੀ ਨਾਲ ਕਈ ਰੁਜ਼ਗਾਰ ਪੈਦਾ ਹੁੰਦੇ ਹਨ ਅਤੇ ਇਹਨਾਂ ਵਿੱਚ ਮਰਦ ਔਰਤ ਦੋਨੇ ਕੰਮ ਕਰਦੇ ਹਨ ਅਤੇ ਰੁਜ਼ਗਾਰ ਦਾ ਇੱਕ ਸੁਨੇਹਾ ਸੁਨਹਿਰਾ ਅਵਸਰ ਬਣਿਆ ਰਹਿੰਦਾ ਹੈ ਜੋ ਕਿ ਛੇ ਮਹੀਨੇ ਸਾਲ ਦਰ ਚੱਲਦਾ ਰਹਿੰਦਾ ਹੈ